ਮੈਂ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰਨਾ ਚਾਹੁੰਦਾ ਹਾਂ ਜਿਵੇਂ ਸਿੱਖਿਆ ਦੀ ਅੱਜ ਕੱਲ੍ਹ ਲੋਕ ਬਹੁਤ ਸਿਆਣੇ ਹੋ ਗਏ ਨੇ ਹਰ ਕੋਈ ਆਪਣਾ ਕਹਿੰਦਾ ਹੈ ਕਿ ਮੇਰੀ ਬੇਟੀ ਪੜ੍ਹ ਕੇ ਵਧੀਆ ਰੁਜ਼ਗਾਰ ਅਤੇ ਵਧੀਆ ਕੰਮ ਕਰੇ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਬ ਬੇਟੀ ਨੂੰ ਆਈਲੈਸ ਕਰਾਉਂਦਾ ਹੈ ਕੋਈ ਕੋਰਸ ਕਰਾਉਂਦਾ ਹੈ ਕੋਈ ਉਹਦੇ ਕੋਲ ਨੌਕਰੀ ਕਰਾਉਂਦਾ ਜਿਵੇਂ ਕੋਈ ਸਰਕਾਰੀ ਨੌਕਰੀ ਆਪਣੀ ਬੇਟੀ ਕਰਾਉਣਾ ਚਾਹੁੰਦਾ ਇਸ ਲਈ ਹਰ ਕੋਈ ਬੰਦਾ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦਾ ਹੈ ਜਿਵੇਂ ਬੇਰੁਜ਼ਗਾਰੀ ਔਰਤ ਲਈ ਰੁਜ਼ਗਾਰੀ ਅੱਜ ਕੱਲ੍ਹ ਨਹੀਂ ਕੋਈ ਖਾਸ ਨਹੀਂ ਹੈ ਜਿਵੇਂ ਸਿਲਾਈ ਦਾ ਕੰਮ ਕਰ ਲੈਣਾ ਕੰਪੂਟਰ ਕਰ ਲੈਣਾ ਕਢਾਈ ਕਰ ਲੈਣਾ ਚਾਹੁੰਦੀ ਹੈ ਜਿਵੇਂ ਹਰ ਕੋਈ ਨੌਕਰੀ ਕਰਨਾ ਚਾਹੁੰਦਾ ਹੈ ਇਸ ਲਈ ਉਹ ਬੇਰੁਜ਼ਗਾਰ ਵੱਲ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਜਿਹੜੀ ਬੇਰੁਜ਼ਗਾਰੀ ਵਾਲੀ ਹੋਵੇ ਇਸ ਲਈ ਹਰ ਇੱਕ ਜਨਾਨੀ ਉਹ ਕੰਮ ਕਰਨਾ ਚਾਹੁੰਦੀ ਆ ਸਮਾਜ ਕਿਸੇ ਜਿਵੇਂ ਅੱਜ ਕੱਲ੍ਹ ਔਰਤ ਨੂੰ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਹੈ ਕਿਉਂ ਮਾਹੌਲ ਇਹੋ ਜਿਹਾ ਹੋ ਚੁੱਕਿਆ ਹੈ ਵੀ ਇਕੱਲੀ ਹੀ ਔਰਤ ਕਿਤੇ ਨਹੀਂ ਜਾ ਸਕਦੀ ਇਸ ਲਈ ਇਸ ਲਈ ਇਹੀ ਗੱਲ ਹੈ ਵੀ ਬੰਦੇ ਨੂੰ ਹਰ ਇੱਕ ਔਰਤ ਨੂੰ ਇਹੋ ਜਿਹਾ ਅਧਿਕਾਰ ਹੋਣਾ ਚਾਹੀਦਾ ਵੀ ਉਹ ਇਕੱਲੀ ਕਿਤੇ ਜਾ ਸਕੇ ਪਰ ਆਪਣੇ ਸਮਾਜ ਵਿੱਚ ਇਹੋ ਜਿਹਾ ਹੋ ਚੁੱਕਾ ਹੈ ਵੀ ਔਰਤ ਇਕੱਲੀ ਨਹੀਂ ਜਾ ਸਕਦੀ ਕਿਉਂਕਿ ਨਸ਼ਿਆਂ ਦਾ ਦੌਰ ਵੱਧ ਚੁੱਕਾ ਹੈ ਇਸ ਲਈ ਹਰ ਇੱਕ ਔਰਤ ਨੂੰ ਆਪਣਾ ਨਾਲ ਜਾਣ ਲਈ ਕਿਸੇ ਆਦਮੀ ਨੂੰ ਜਾਂ ਕਿਸੇ ਘਰ ਵਾਲੇ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਇਸ ਲਈ ਮੈਂ ਕਹਿਣਾ ਚਾਹੁੰਦਾ ਹੈ ਵੀ ਆਪਣੇ ਤਰਨ ਤਾਰਨ ਜ਼ਿਲ੍ਹੇ ਵਿੱਚ ਇਹੀ ਸੁਰੱਖਿਆ ਹੋਣੀ ਚਾਹੀਦੀ ਹੈ ਕਿ ਵੀ ਔਰਤ ਇਕੱਲੀ ਵੀ ਕਿਤੇ ਜਾ ਸਕਣੇ ਚਾਹੀਦੀ ਹੈ